ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੈ ਜੀ ਹਾਂਜੀ ਬਸ ਵਧੀਆ ਜੀ ਤੁਸੀਂ ਸੁਣਾਓ ਬੱਚੇ ਕੀ ਕਰਦੇ ਹੈ ਬਸ ਮੈਂ ਤਾਂ ਜੀ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਅੱਜ ਕੱਲ੍ਹ ਬਾਹਰ ਨੂੰ ਜਿਹੜੇ ਬੱਚੇ ਜਾਈ ਜਾਂਦੇ ਹੈ ਇਹਦਾ ਦਾ ਕਾਰਨ ਕੀ ਹੈ ਇਹਦੇ ਇਹਦੇ ਬਾਰੇ ਗੱਲ ਕਰਨੀ ਸੀ ਜੀ ਦੋ ਮਿੰਟ ਹਾਂ ਕਾਤੇ ਕਿਹੜੀ ਗੱਲ 'ਤੇ ਬਾਹਰ ਜਾ ਰਹੇ ਬੱਚੇ ਅੱਜ ਕੱਲ੍ਹ ਦੇ ਜਿਹਦੇ ਵੀ ਦੇਖੋ ਮੇਰਾ ਬੇਟਾ ਵੀ ਕਹਿੰਦਾ ਮੈਂ ਬਾਹਰ ਨੂੰ ਜਾਣਾ ਹੈ ਇਹ ਬਾਹਰ ਜਾਣ ਦਾ ਕਾਰਨ ਕਿਆ ਹੈ ਜੀ ਆਪਾਂ ਆਮ ਕਰਕੇ ਦੇਖਦੇ ਹੈ ਜਿਹੜਾ ਵੀ ਦੇਖੋ ਹਰੇਕ ਕਹਿੰਦਾ ਬਾਹਰ ਜਾਣਾ ਬਾਹਰ ਜਾਣਾ ਹਾਂ ਇਹਦਾ ਮੇਨ ਕਾਰਨ ਕਿਆ ਮੇਰੀ ਹਾਂ ਮੈਂ ਵੀ ਇਹੀ ਹਿਸਾਬ ਲਾਉਂਦਾ ਹੁੰਦਾ ਵੀ ਇੱਥੇ ਜਿਹੜੀ ਬੇਰੋਜਗਾਰੀ ਜ਼ਿਆਦਾ ਹੈ ਇਹਦੇ ਕਰਕੇ ਜ਼ਿਆਦਾ ਤਾਂ ਇਹਦੇ ਕਰਕੇ ਹੀ ਕਦਮ ਚੱਕਦੇ ਆ ਵੀ ਆਪਾਂ ਬਾਹਰ ਚੱਲੀਏ ਕੰਮ ਤਾਂ ਕੋਈ ਇੱਥੇ ਵੀ ਕਰਨਾ ਈ ਪੈਣਾ ਬਾਹਰ ਵੀ ਕਰਨਾ ਈ ਪੈਣਾ ਜੀ ਹਾਂਜੀ ਹਾਂਜੀ ਹਾਂਜੀ ਅਤੇ ਨੰਬਰ ਦੋ 'ਤੇ ਹੁਣ ਸੀਨੀਅਰ ਸਿਟੀਜਨ ਆਪਾਂ ਹੋ ਗਏ ਅਤੇ ਓ ਜੇ ਕੱਲ੍ਹ ਨੂੰ ਫਿਰ ਸਾਨੂੰ ਵੀ ਕੌਣ ਸਾਂਭੇ ਸਾਰੇ ਬੱਚੇ ਬਾਹਰ ਹੀ ਚਲੇ ਗਏ ਲਗਭਗ ਬਾਹਠ ਦੇ ਗੇੜ 'ਤੇ ਤਾਂ ਮੈਂ ਪਹੁੰਚ ਗਿਆ ਤੁਹਾਡੀ ਤਾਂ ਜ਼ਿਆਦਾ ਹੋਣੀ ਹੈ ਸ਼ਾਇਦ ਅਤੇ ਇਹ ਕਈ ਵਾਰੀ ਹਾਂਜੀ ਕਈ ਵਾਰੀ ਇਹ ਹਿਸਾਬ ਲਾਈਦਾ ਵੀ ਕਿਆ ਬਣੂਗਾ ਅੱਗੇ ਅੱਗੇ ਹੋਰ ਹਾਂਜੀ ਵੈਸੇ ਤਾਂ ਇਹ ਤਾਂ ਰੱਬ ਦੇ ਹੱਥਾਂ ਪਾ ਡੋਰੀ ਸਿੱਟ ਦਿੰਦੇ ਆਪਾਂ ਜਾਣੀ ਹਾਂ ਵੈਸੇ ਆਮ ਕਰਕੇ ਦੇਖਿਆ ਗਿਆ ਹੈ ਕਿਸੇ ਨੂੰ ਵੀ ਪੁੱਛ ਲੋ ਉਹ ਕਹਿੰਦਾ ਜੀ ਮੇਰੀ ਬੇਟੀ ਬਾਹਰ ਆ ਉਹ ਕਹਿੰਦਾ ਮੇਰਾ ਬੇਟੀ ਕਾਹ 'ਤੇ ਗਿਆ ਸ ਸਟੱਡੀ ਬੇਸ 'ਤੇ ਗਿਆ ਉੱਥੇ ਵੀਜ਼ਾ ਲੱਗ ਜਾਵੇਗਾ ਵਰਕ ਵਰਕ ਵੀਜ਼ਾ ਲੱਗਜੇਗਾ ਅਤੇ ਆਮ ਕਰਕੇ ਏ ਏਹੀ ਸੁਣਿਆ ਜਾ ਰਿਹਾ ਹਾਂਜੀ ਚਲੋ ਠੀਕ ਹੈ ਜੀ ਫਿਰ ਮਿਹਰਬਾਨੀ ਓਕੇ ਓਕੇ ਸਤਿ ਸ਼੍ਰੀ ਅਕਾਲ